ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਆ ਅਤੇ ਜਦੋਂ ਅਸੀਂ ਸਟੂਡੈਂਟਸ ਸੀ ਉਦੋਂ ਮਤਲਬ ਕਿ ਸਾਡਾ ਕਰੋਨਾ ਟਾਈਮ ਆ ਗਿਆ ਸੀ ਅਤੇ ਕਰੋਨਾ ਟਾਈਮ ਦੇ ਵਿੱਚ ਸਾਰੇ ਲੋਕਡਾਊਨ ਹੋ ਗਿਆ ਅਤੇ ਸਕੂਲ ਸਕਾਲ ਕੋਲਜ ਸਭ ਬੰਦ ਹੋ ਗਏ ਸੀ ਉਦੋਂ ਬੱਚਿਆਂ ਦੀਆਂ ਕਲਾਸਾਂ 'ਚ ਸਾਡੀਆਂ ਕਲਾਸ ਉਹ ਔਨਲਾਈਨ ਲੱਗਦੀਆਂ ਹੁੰਦੀਆਂ ਸੀ ਜੀ ਜ਼ੂਮ ਐਪ 'ਤੇ ਅਤੇ ਉਦੋਂ ਅਸੀਂ ਜ਼ੂਮ ਐਪ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਸੀ ਜਿਹੜੀ ਕਿ ਇੱਕ ਵੀਡੀਓ ਕਾਨਫਰਸਿੰਗ ਐਪ ਹੈ ਜਿੱਥੇ ਅਸੀਂ ਵੀਡੀਓ ਤਾਂ ਵੀਡੀਓ ਜਾਂ ਔਡੀਓ ਰਾਹੀਂ ਇੱਕ ਦੂਜੇ ਨਾਲ ਪੂਰੀ ਟੀਚਰ ਵੀਡੀਓ ਲਾਉਂਦੇ ਸੀ ਅਤੇ ਪੂਰੀ ਕਲਾਸ ਜੁੜ ਜਾਂਦੇ ਸੀ ਅਤੇ ਜਿੱਥੇ ਕਲਾਸ ਲੈਂਦੇ ਸੀ ਔਨਲਾਈਨ ਇਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਕੁਝ ਇਸ ਚੀਜ਼ ਵੀ ਹੈਗੀ ਆ ਜਿੱਦਾਂ ਆਪਾਂ ਜਦੋਂ ਇਕੱਠੇ ਕਲਾਸ ਇਕੱਠ ਨਾ ਹੋ ਪਾਵੇ ਅਤੇ ਨਾ ਜੁੜ ਕੇ ਮੀਟਿੰਗ ਕਰ ਸਕਦੇ ਹਾਂ ਤਾਂ ਇਸ 'ਤੇ ਸਾਨੂੰ ਬਹੁਤ ਲਾਭ ਹੋਏ ਕਿ ਬੱਚਿਆਂ ਨੇ ਮਤਲਬ ਕਿ ਦੂਰ ਬੈਠੇ ਕਿਤੋ ਕਿਤੇ ਵੀ ਹੋ ਕੇ ਅਸੀਂ ਮੀਟਿੰਗ ਇੱਕ ਦੂਸਰੇ ਨਾਲ ਗੱਲ ਕਰ ਸਕਦੇ ਸੀ ਜਿਹੜੇ ਕਿ ਬਹੁਤ ਵਧੀਆ ਹੈ ਜਿਸ ਨਾਲ ਸਾਨੂੰ ਪਤਾ ਲੱਗਾ ਕਿ ਅਸੀਂ ਹੋਰ ਵੀ ਤਰੀਕੇ ਆ ਜਿਹਨਾਂ ਨਾਲ ਅਸੀਂ ਜੁੜ ਸਕਦੇ ਹਾਂ ਜਾਂ ਇੱਕ ਦੂਸਰੇ ਨਾਲ ਗੱਲਬਾਤ ਕਰ ਸਕਦੇ ਹਾਂ ਸਾਨੂੰ ਇਸ ਤਰ੍ਹਾਂ ਦੇ ਹੋਰ ਵੀ ਕਈ ਯੰਤਰ ਦਾ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਹੋਰ ਵੀ ਕਈ ਹਨ ਜਿਨਾਂ ਨਾਲ ਅਸੀਂ ਇਹੋ ਜਿਹੀ ਤਕਨੀਕਾਂ ਅਪਣਾ ਕੇ ਆਪਣੇ ਉਤਪੱਤੀ ਕਰ ਸਕਦੇ ਹਾਂ ਜਿਹੜਾ ਕਿ ਬਹੁਤ ਵਧੀਆ ਹੈ ਸੋ ਸਾਨੂੰ ਹੋਰ ਵੀ ਇਸ ਜ਼ੂਮ ਐਪ ਬਾਰੇ ਜਾਣਨਾ ਚਾਹੀਦਾ ਹੈ ਇਸ ਦੇ ਬਹੁਤ ਵਧੀਆ ਕਈ ਕਈ ਫੀਚਰ ਹਨ ਜਿੱਦਾਂ ਕਿ ਅਸੀਂ ਇੱਕ ਦੂਜੇ ਨੂੰ ਸਾਹਮਣੇ ਦੇਖ ਸਕਦੇ ਹਾਂ ਗੱਲ ਕਰ ਸਕਦੇ ਹਾਂ ਅਤੇ ਇਸ ਦੇ ਕਈ ਨਾਪਸੰਦ ਵੀ ਹੈਗੇ ਹਨ ਕਿ ਬੰਦੇ ਨੂੰ ਮਿਲਣ ਦੀ ਚਾਹ ਘੱਟ ਜਾਂਦੀ ਹੈ ਇਸ ਨਾਲ ਇੱਕ ਦੂਜੇ ਨਾਲ ਜੇ ਅਸੀਂ ਕਿਸੇ ਨੂੰ ਦੇਖ ਲਈਏ ਅਸੀਂ ਕਹਿੰਦੇ ਹਾਂ ਕਿ ਚਲੋ ਗੱਲ ਤਾਂ ਕਰ ਲਈ ਆ ਹੁਣ ਕੀ ਉਹਨੂੰ ਮਿਲਣ ਜਾਣਾ ਸੋ ਇਸ ਦੇ ਕਈ ਨਾਪਸੰਦ ਕਰਨ ਵਾਲੀਆਂ ਵੀ ਚੀਜ਼ਾਂ ਵੀ ਹਨ ਬਾਕੀ ਕਾਫੀ ਵਧੀਆ ਚੀਜ਼ ਹੈ ਪਲੇਟਫਾਰਮ ਬਹੁਤ ਵਧੀਆ ਹੈ ਸੋ ਧੰਨਵਾਦ